ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਆ ਹੈ ਅਤੇ ਮੈਂ ਇੱਕ ਪਿੰਡ ਵਿੱਚ ਰਹਿਣ ਵਾਲੀ ਹਾਂ ਮੈਂ ਆਪਣੇ ਪਿੰਡ ਵਿੱਚ ਹੀ ਇੱਕ ਦੁਕਾਨ ਖੋਲ੍ਹੀ ਹੋਈ ਹੈ ਜਿਸ ਵਿੱਚ ਮੈਂ ਆਪਣੇ ਕੱਪੜਿਆਂ ਦੀ ਸਿਲਾਈ ਕਢਾਈ ਕਰਦੀ ਹਾਂ ਅਤੇ ਇਹ ਬਹੁਤ ਹੀ ਚੰਗੀ ਚੱਲ ਰਹੀ ਹੈ ਜੇਕਰ ਮੈਂ ਆਪਣੇ ਪਰਿਵਾਰਾਂ ਦੀ ਗੱਲ ਕਰਾਂ ਤਾਂ ਹਰ ਪ੍ਰਕਾਰ ਦੇ ਘਰ ਪਰਿਵਾਰਾਂ ਨੂੰ ਮੈਨੂੰ ਡੀਲ ਕਰਨਾ ਪੈਂਦਾ ਹੈ ਅਤੇ ਉਹ ਬਹੁਤ ਹੀ ਕੋਪ੍ਰੇਟਿਵ ਹਨ ਅਤੇ ਉਹਨਾਂ ਦੀ ਜ਼ਰੂਰਤਾਂ ਨੂੰ ਮੈਂ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੀ ਹਾਂ ਮੇਰੇ ਕੋਲ ਹਰ ਤਰ੍ਹਾਂ ਦਾ ਖਪਤਕਾਰ ਆਉਂਦਾ ਹੈ ਜਿਵੇਂ ਕਿ ਕੋਈ ਸੂਟ ਸਲਵਾਰ ਸੂਟ ਸਵਾਉਣ ਲਈ ਆਉਂਦਾ ਹੈ ਅਤੇ ਕੋਈ ਚੂੜੀਦਾਰ ਸਿਲਵਾਉਣ ਲਈ ਆਉਂਦਾ ਹੈ ਅਤੇ ਉਹਨਾਂ ਦੀਆਂ ਅਲੱਗ ਅਲੱਗ ਡਿਮਾਂਡਾਂ ਹੁੰਦੀਆਂ ਹਨ ਅਤੇ ਮੈਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਡਿਮਾਂਡਾਂ ਨੂੰ ਪੂਰੀ ਕਰਦੀ ਹਾਂ ਅਤੇ ਉਹਨਾਂ ਨੂੰ ਉਹ ਖੁਸ਼ ਹੋ ਜਾਂਦੇ ਹਨ ਅਤੇ ਕੁਝ ਇੱਦਾਂ ਦੇ ਵੀ ਖਪਤਕਾਰ ਆਉਂਦੇ ਹਨ ਜੋ ਮੈਨੂੰ ਉਸੇ ਸਮੇਂ ਪੈਸੇ ਦੇ ਦਿੰਦੇ ਹਨ ਅਤੇ ਕੁਝ ਅ ਮਜ਼ਬੂਰ ਹੁੰਦੇ ਹਨ ਅਤੇ ਉਹ ਉਸ ਸਮੇਂ ਪੈਸੇ ਨਹੀਂ ਦੇ ਸਕਦੇ ਅਤੇ ਉਧਾਰੀ ਕਰ ਲੈਂਦੇ ਹਨ ਅ ਪਰ ਖਤਪਰਵਾਰ ਇੰਨੇ ਚੰਗੇ ਹਨ ਕਿ ਉਹ ਕੁਝ ਸਮੇਂ ਪਾ ਕੇ ਚਾਹੇ ਥੋੜ੍ਹਾ ਟਾਈਮ ਲੈ ਕੇ ਉਹ ਮੈਨੂੰ ਪੈਸੇ ਦੇ ਦਿੰਦੇ ਹਨ ਮੇਰੇ ਪੈਸੇ ਨਹੀਂ ਮਾਰਦੇ ਹਨ ਅਤੇ ਇਸ ਕੰਮ ਮੇਰੇ ਕੋਲੋਂ ਇਕੱਲੇ ਨਹੀਂ ਹੋ ਪਾਉਂਦਾ ਇਸ ਕਰਕੇ ਮੈਂ ਦੋ ਤਿੰਨ ਕੁੜੀਆਂ ਰੱਖੀਆਂ ਹੋਈਆਂ ਹਨ ਆਪਣੇ ਨਾਲ ਅਤੇ ਕੁਝ ਇੱਕ ਦੋ ਬੱਚਾ ਮੇਰੇ ਕੋਲ ਸਿੱਖਣ ਵੀ ਆਉਂਦਾ ਹੈ ਜਿਸ ਨੂੰ ਮੈਂ ਫਰੀ ਹੀ ਸਿਖਲਾਈ ਕਰਵਾਉਂਦੀ ਹਾਂ ਅਤੇ ਜੇਕਰ ਗੱਲ ਕੀਤੀ ਜਾਵੇ ਕਿ ਮੈਨੂੰ ਕਿੰਨੇ ਕੱਪੜੇ ਦੇ ਇੱਕ ਟੁਕੜੇ ਦਾ ਕਿੰਨਾ ਸੂ ਪੈ ਜਾਂਦਾ ਹੈ ਤਾਂ ਜ਼ਿਆਦਾਤਰ ਤਾਂ ਮੈਂ ਆਪਣੇ ਕੱਪੜੇ ਲੈ ਕੇ ਤਾਂ ਸੀਂਦੀ ਨਹੀਂ ਕਿਉਂਕਿ ਮੇਰੇ ਕੋਲ ਕਸਟਰਮਰ ਜਿਹੜੇ ਹੈ ਉਹ ਆਪਣਾ ਹੀ ਸੂਟ ਲੈ ਕੇ ਆਪਣਾ ਕੱਪੜਾ ਲੈ ਕੇ ਹੀ ਆਉਂਦੇ ਹਨ ਅਤੇ ਮੈਂ ਬਸ ਸਟੀਚਿੰਗ ਦੇ ਹੀ ਪੈਸੇ ਲੈਂਦੀ ਹਾਂ ਅਤੇ ਮੈਂ ਇੱਕ ਸੂਟ ਦਾ ਜੇ ਕੋਈ ਲਾਈਨਿੰਗ ਵਾਲਾ ਸੂਟ ਸਲਵਾਰ ਸੂਟ ਹੈਗਾ ਤਾਂ ਉਸਦੀ ਪੰਜ ਸੌ ਲੈਂਦੀ ਹਾਂ ਅਤੇ ਜੇ ਕੋਈ ਸਿੰਪਲ ਸੂਟ ਹੈ ਤਾਂ ਉਹਦਾ ਮੈਂ ਢਾਈ ਸੌ ਰੁਪਏ ਲੈ ਚਾਰਜ ਕਰਦੀ ਹਾਂ ਅਤੇ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਮੈਨੂੰ ਆਪਣੇ ਕਸਟਮਰ ਨੂੰ ਦੇਖਣਾ ਪੈਂਦਾ ਹੈ ਕਿ ਉਹ ਪੇ ਕਰ ਪਾਉਂਦਾ ਹੈ ਜਾਂ ਨਹੀਂ ਅਤੇ ਉਹ ਉਹਨਾਂ ਨੂੰ ਦੇਖ ਕੇ ਮੈਂ ਆਪਣੀ ਕੀਮਤ ਜਿਹੜੀ ਹੈ ਉਹ ਘਟਾ ਵੀ ਲੈਂਦੀ ਹਾਂ ਅਤੇ ਇਸ ਕਰਕੇ ਮੇਰੇ ਕੋਲ ਹਰ ਤਰ੍ਹਾਂ ਦਾ ਗਾਹਕ ਜਿਹੜਾ ਹੈ ਉਹ ਆਉਂਦਾ ਹੈ ਧੰਨਵਾਦ